ਹੈਲੋ ਪੰਚਮ ਕਿੱਦਾਂ ਠੀਕ ਹੈ ਠੀਕ ਹੈ ਹੋਰ ਬਹੁਤ ਯਾਦ ਆਉਂਦੀ ਟਾਈਮ ਨਹੀਂ ਲੱਗਦਾ ਹੋਰ ਨਹੀਂ ਨਹੀਂ ਜੀ ਯਾਦ ਰਹਿੰਦੇ ਤੁਸੀਂ ਦਿਲ 'ਚ ਰਹਿੰਦੇ ਤੁਸੀਂ ਹੋਰ ਸੁਣਾਓ ਕਿੱਦਾਂ ਹਾਲ ਚਾਲ ਬਸ ਠੀਕ ਯਾਰ ਬਸ ਅੱਜ ਕੱਲ੍ਹ ਠੀਕ ਹੈ ਮੌਸਮ ਕਿੱਦਾਂ ਦਾ ਅੱਜ ਕੱਲ੍ਹ ਅੱਛਾ ਅੱਛਾ ਬਾਰਵੀਂ ਸੋਚਾਂਗੇ ਰਿਜਲਟ ਆਵੇਗਾ ਰਿਜਲਟ ਨੰਬਰ ਆਉਣਗੇ ਤਾਂ ਹੀ ਪਤਾ ਹੋਣਾ ਕੀ ਕਰੀਏ

ਅੱਛਾ ਅੱਛਾ ਹੋਰ ਉਹ ਉੱਥੇ ਫਾਰਮ ਭਰਾਉਂਦੇ ਹੋਣੇ ਫਾਰਮ ਭਰ ਗਏ ਅੱਛਾ ਅੱਛਾ ਹਮ ਹਮ ਅ ਅੱਛਾ ਅੱਛਾ ਹਾਂ ਹਾਂ ਠੀਕ ਹੈ ਫਿਰ ਅੱਛਾ ਅੱਛਾ ਮੌਸਮ ਠੀਕ ਹੈ ਇੱਥੇ ਵੀ ਹਮ ਠੰਡ ਠੰਡ ਤਾਂ ਹੁੰਦੀ ਇੱਥੇ ਤਾਂ ਸਵੇਰੇ ਸ਼ਾਮ ਠੰਡ ਬਹੁਤ ਹੈ ਕੱਪੜੇ ਨਹੀਂ ਸੁੱਕਦੇ ਕੁਛ ਨਹੀਂ ਸੁਕਦਾ ਇੱਥੇ ਤਾਂ ਸਭ ਕੁਛ ਅੱਛਾ ਅੱਛਾ ਹਾਂ ਹਾਂ ਜੀ ਮੇਰੇ ਵਾਸਤੇ ਅੱਛਾ ਅੱਛਾ ਅੱਛਾ ਅੱਛਾ ਹਮ ਹਮ ਸ਼ਿਮਲੇ ਦਾ ਬਹੁਤ ਠੰਡ ਹੁੰਦੀ ਸ਼ਿਮਲੇ ਤਾਂ ਸ਼ਿਮਲਾ ਬਹੁਤ ਆ ਹਮ ਹਾਂ ਸ਼ਿਮਲੇ ਤਾਂ ਬਹੁਤ ਬੁਰਾ ਹਾਲ ਹੈ ਸਵੇਰੇ ਸ਼ਾਮ ਬਹੁਤ ਠੰਡ

ਹਮ ਮੈਂ ਕੁਛ ਤੁਸੀਂ ਹਾਂ ਹਾਂ ਸ਼ਿਮਲਾ ਆਓ ਤੁਸੀਂ ਬਹੁਤ ਠੰਡ ਹੁੰਦੀ ਸ਼ਿਮਲੇ ਨਾ ਹਮ ਹੋਰ ਘੁੰਮਣਾ ਮੌਸਮ ਵੇਖੋ ਕਿੱਦਾਂ ਦਾ ਹੁੰਦਾ ਅਤੇ ਸਵੇਰੇ ਸ਼ਾਮ ਦਾ ਹਮ ਹਾਂ ਇੱਥੇ ਗਰਮੀ ਆਉਂਦੀ ਉੱਥੇ ਅਤੇ ਉੱਥੇ ਉਹ ਤਾਂ ਠੰਡ ਜਾਂਦੀ ਨਾ ਸਾਲ ਠੰਡ ਜਾਂਦੇ ਸਾਲ ਭਰ ਠੰਡ ਹੀ ਰਹਿੰਦੀ ਹਾ ਹਾਂ ਬਣਾਊਂਗੇ ਪ੍ਰੋਗਰਾਮ ਨਾ ਬਣਾਓ ਪ੍ਰੋਗਰਾਮ ਫਿਰ ਅੱਛਾ ਅੱਛਾ ਹਾਂ ਹਾਂ ਠੀਕ ਹੈ ਠੀਕ ਹੈ ਕੋਈ ਨਹੀਂ ਦੇਖਦੇ ਹਾਂ ਹਾਂ ਜੂਨ ਜੁਲਾਈ 'ਚ ਜ਼ਿਆਦਾ ਗਰਮੀ ਹੁੰਦੀ ਨਾ

ਉੱਥੇ ਤਾਂ ਜ਼ਿਆਦਾ ਹੁੰਦੀ ਬਸ ਹੋਰ ਹਾਂ ਸ਼ਿਮਲਾ ਜ਼ਿਆਦਾ ਹੁੰਦੀ ਚਲੋ ਚਲੋ ਠੀਕ ਆ ਅੱਛਾ ਚਲੋ ਠੀਕ ਆ ਚਲ ਠੀਕ ਹੈ ਨਾ ਫਿਰ ਮਿਲ ਲੈਣਾ ਜਦੋਂ ਆਓਗੇ ਫਿਰ ਹਾਂ ਕੋਈ ਨਹੀਂ ਕੋਈ ਠੀਕ ਹੈ ਬਾਏ ਜੀ ਓਕੇ